ਮੈਂ ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਵਸਨੀਕ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜੀਵਨ ਵਿੱਚ ਕਸਰਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਸਾਡੇ ਪਿੰਡ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਬਰਨਾਲਾ ਸ਼ਹਿਰ ਵਿੱਚ ਸਥਿਤ ਕਾਲਾ ਮਿੱਲ ਸਟੇਡੀਅਮ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਰਨਿੰਗ ਵੀ ਕਰਵਾਈ ਜਾਂਦੀ ਹੈ ਦੌੜ ਦੌੜ ਕਰਵਾਈ ਜਾਂਦੀ ਹੈ ਤਾਂ ਕਿ ਬੱਚਿਆਂ ਨੂੰ ਇੱਕ ਵਧੀਆ ਸੰਤੁਸ਼ਟੀ ਪੈਦਾ ਹੋ ਸਕੇ ਅਤੇ ਉਹ ਵੀ ਕੁਝ ਖੇਡਾਂ ਵੱਲ ਧਿਆਨ ਦੇ ਸਕਣ ਉਸ ਨਾਲ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਵੱਖ ਵੱਖ ਮੌਸਮੀ ਸਥਿਤੀਆਂ ਜਿਵੇਂ ਕਿ ਗਰਮ ਠੰਡ ਬਰਸਾਤ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਰਨਿੰਕ ਦੌੜਾਂ ਕਰਵਾਈਆਂ ਜਾਂਦੀਆਂ ਹਨ ਉੱਥੇ ਬਹੁਤ ਵਧੀਆ ਪ੍ਰੈਕਟਿਸ ਕਰਵਾਈ ਜਾਂਦੀ ਹੈ ਗਰਮੀ ਵਿੱਚ ਗਰਮੀ ਵਿੱਚ ਟੀ ਸ਼ਰਟ ਅਤੇ ਸ਼ਾਰਟਸ ਪਾ ਕੇ ਉੱਥੇ ਰਨਿੰਗ ਕਰਵਾਈ ਜਾਂਦੀ ਹੈ ਦੌੜਾਂ ਕਰਵਾਈਆਂ ਜਾਂਦੀਆਂ ਹਨ ਖੇਡਾਂ ਕਰਵਾਈਆਂ ਜਾਂਦੀਆਂ ਹਨ ਠੰਡ ਵਿੱਚ ਟਰੈਕ ਸੂਟ ਪਵਾ ਕੇ ਅਤੇ ਵਧੀਆ ਬੂਟ ਪਾ ਕੇ ਪ੍ਰੈਕਟਿਸ ਕਰਵਾਈ ਜਾਂਦੀ ਹੈ ਬਰਸਾਤ ਦੇ ਮੌਸਮ ਵਿੱਚ ਵੀ ਉੱਥੇ ਪ੍ਰੈਕਟਿਸ ਕਰਵਾਈ ਜਾਂਦੀ ਹੈ ਟਰੈਕ ਸੂਟ ਪਾ ਕੇ ਦੌੜਨ ਹਾਲੇ ਜੀ ਸਾਨੂੰ ਇੰਨੇ ਸੁਝਾਅ ਹੋਣੇ ਬਹੁਤ ਹਨ ਜ਼ਰੂਰੀ ਹਨ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਵੀ ਕਿੱਦਾਂ ਕੰਮ ਕਰਨਾ ਹੈ ਦੌੜਨਾ ਇੱਕ ਸਾਡੇ ਸਰੀਰ ਦੀ ਬਣਾਵਟ ਬਣਾਉਣ ਲਈ ਬਹੁਤ ਜ਼ਰੂਰੀ ਹੈ ਦੌੜ ਭੱਜ ਕਰਨ ਨਾਲ ਸਾਨੂੰ ਖਾਲੀ ਪੇਟ ਸੁਬਹਾ ਰਨਿੰਗ ਕਰਨੀ ਹੀ ਚਾਹੀਦੀ ਹੈ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ਨੂੰ ਵੀ ਤੰਦਰੁਸਤੀ ਮਿਲਦੀ ਹੈ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਨਾ ਹੀ ਸਾਡੇ ਨੇੜੇ ਕੋਈ ਬਿਮਾਰੀ ਆਉਂਦੀ ਹੈ ਅਤੇ ਨਾ ਹੀ ਕੋਈ ਹੋਰ ਦਿੱਕਤ ਆਉਂਦੀ ਹੈ ਇਸ ਲਈ ਸਾਡੀ ਜ਼ਿੰਦਗੀ ਵਿੱਚ ਇਸ ਚੀਜ਼ ਦਾ ਹੋਣਾ ਵੀ ਜ਼ਰੂਰੀ ਹੈ ਸਾਨੂੰ ਕਸਰਤ ਵਗੈ ਕਸਰਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਰਨਿੰਗ ਵਗੈਰਾ ਕਰਦੇ ਰਹਿਣਾ ਚਾਹੀਦਾ ਅਤੇ ਦੌੜਨਾ ਤਾਂ ਬਹੁਤ ਜ਼ਰੂਰੀ ਹੈ ਵੱਖ ਵੱਖ ਮੌਸਮ ਸਥਿਤੀਆਂ ਜਿਵੇਂ ਕਿ ਗਰਮ ਠੰਡ ਬਰਸਾਤ ਵਿੱਚ ਦੌੜਨ ਲਈ ਸਾਨੂੰ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਜਾਂਦੇ ਹਨ ਜਿਵੇਂ ਅਸੀਂ ਟਰੈਕ ਸੂਟ ਪਾ ਕੇ ਵੀ ਦੌੜ ਸਕਦੇ ਹਾਂ ਸੂਟ ਟੀ ਸ਼ਰਟ ਸ਼ੋਰਟਸ ਪਾ ਕੇ ਵੀ ਦੌੜ ਸਕਦੇ ਹਾਂ